ਮੈਂ ਭਾਰਤ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਭਾਰਤੀ ਮੀਡੀਆ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਭਾਰਤੀ ਮੀਡੀਆ ਸਭ ਕੁਛ ਦੱਸਦੀ ਹੈ ਜੋ ਵੀ ਭਾਰਤ ਵਿੱਚ ਚੱਲ ਰਿਹਾ ਹੈ ਜਾਂ ਉਸ ਦੇ ਆਸ ਪੜੋਸ ਦੇ ਦੇਸ਼ਾਂ ਵਿੱਚ ਚੱਲ ਰਿਹਾ ਹੁੰਦਾ ਹੈ ਭਾਰਤੀ ਮੀਡੀਆ ਨਾਲ ਸਾਨੂੰ ਕਾਫੀ ਕੁਛ ਪਤਾ ਲੱਗ ਲੱਗ ਜਾਂਦਾ ਹੈ ਜਿਵੇਂ ਸਬਜ਼ੀਆਂ ਦੇ ਕੀ ਦਾਮ ਚੱਲਦੇ ਹਨ ਜਾਂ ਫਿਰ ਪੈਟਰੋਲ ਦੇ ਕੀ ਦਾਮ ਹਨ ਸੋਨਾ ਚਾਂਦੀ ਵੀ ਪਤਾ ਚੱਲ ਜਾਂਦਾ ਹੈ ਕਿ ਕਦੋਂ ਸਸਤਾ ਹੋਵੇਗਾ ਜਾਂ ਹੁਣ ਮਹਿੰਗਾ ਚੱਲ ਰਿਹਾ ਹੈ ਇਸ ਤੋਂ ਇਲਾਵਾ ਕਾਫੀ ਚੀਜ਼ਾਂ ਸਾਨੂੰ ਪਤਾ ਚੱਲ ਜਾਂਦੀਆਂ ਹਨ ਜਿਵੇਂ ਹਾਲੀਵੁੱਡ ਬਾਲੀਵੁੱਡ ਦੇ ਫਿਲਮ ਕਲਾਕਾਰ ਕੀ ਕਰਦੇ ਹਨ ਕਿਵੇਂ ਰਹਿੰਦੇ ਹਨ ਇਸ ਤੋਂ ਇਲਾਵਾ ਵੀ ਕਾਫੀ ਚੀਜ਼ਾਂ ਬਹੁਤ ਬਹੁਤ ਚੰਗੀ ਤਰ੍ਹਾਂ ਸਾਨੂੰ ਪਤਾ ਚੱਲ ਜਾਂਦੀਆਂ ਹਨ ਵੈਸੇ ਤਾਂ ਅੱਜ ਕੱਲ੍ਹ ਦੇ ਕਈ ਅਖਬਾਰ ਅਖਬਾਰ ਵਿਕੇ ਹੋਏ ਹੁੰਦੇ ਹਨ ਤਾਂ ਕਰਕੇ ਉਨ੍ਹਾਂ ਵਿੱਚ ਢੁੱਕਵੀਆਂ ਖਬਰਾਂ ਨਹੀਂ ਮਿਲਦੀਆਂ ਪ੍ਰੰਤੂ ਕਈ ਅਖਬਾਰਾਂ ਦੇ ਤੱਥ ਬਿਲਕੁਲ ਸਹੀ ਦਿਖਾਉਂਦੇ ਹਨ ਜਿਵੇਂ ਜਿਵੇਂ ਕਿ ਸਾਨੂੰ ਕਈ ਵਾਰ ਬਹੁਤ ਗੱਲਾਂ ਪੁਲਿਸ ਰਾਹੀਂ ਪਤਾ ਨਹੀਂ ਚੱਲਦੀਆਂ ਪ੍ਰੰਤੂ ਉਹ ਹੋ ਚੁੱਕੀਆਂ ਹੁੰਦੀਆਂ ਹਨ ਮੈਨੂੰ ਕਾਫੀ ਮਸ਼ਹੂਰ ਅਖਬਾਰ ਅਤੇ ਨਿਊਜ਼ ਚੈਨਲਾਂ ਬਾਰੇ ਜਾਣਕਾਰੀ ਹੈ ਜਿਵੇਂ ਅਖਬਾਰ ਵਿੱਚ ਪੰਜਾਬ ਕੇਸਰੀ ਹਿੰਦੂਸਤਾਨ ਟਾਈਮਜ਼ ਹੋਰ ਆਦਿ ਕਈ ਅਖਬਾਰਾਂ ਹਨ ਅਤੇ ਨਿਊਜ਼ ਚੈਨਲ ਪੀ ਟੀ ਸੀ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਕਈ ਤਰ੍ਹਾਂ ਦੇ ਚੈਨਲ ਹਨ ਜਿਨ੍ਹਾਂ ਬਾਰੇ ਸਾਨੂੰ ਕਾਫੀ ਜਾਣਕਾਰੀ ਮਿਲ ਜਾਂਦੀ ਹਨ